ਜੇ ਸੁਰੱਖਿਆ ਚਿੰਤਾਵਾਂ ਦੀ ਗੱਲ ਕਰੀਏ ਕਿ ਜਿਹੜੇ ਟੂਰਿਸਟ ਨੇ ਬਾਹਰਲੇ ਸੈਲਾਨੀ ਲੋਕ ਹੈ ਜੋ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਆ ਘੁੰਮਣਾ ਫਿਰਨਾ ਚਾਹੁੰਦੇ ਆ ਉਹਨਾਂ ਬਾਰੇ ਇੱਕ ਗੱਲ ਦੱਸ ਦਈਏ ਕਿ ਐਸੀ ਚਿੰਤਾ ਜਾਂ ਐਸੀਆਂ ਚਿੰਤਾਵਾਂ ਕੋਈ ਨਹੀਂ ਹੈ ਜੋ ਕਿ ਕਿਸੇ ਸੈਲਾਨੀ ਨੂੰ ਜਾਂ ਸੈਲਾਨੀਆਂ ਨੂੰ ਕਰਨੀਆਂ ਚਾਹੀਦੀਆਂ ਕਿਉਂਕਿ ਪੰਜਾਬ ਇੱਕ ਬਹੁਤ ਸੁਰੱਖਿਅਤ ਬੜਾ ਇਮਾਨਦਾਰ ਰਾਜ ਹੈ ਕਿ ਜਿਸ ਕਰਕੇ ਇੱਕ ਪੰਜਾਬ ਦੇ ਵਿੱਚ ਯਾਤਰਾ ਕਰਨ ਵਾਲੇ ਲੋਕ ਲੋਕਾਂ ਨੂੰ ਜਾਂ ਸੈਲਾਨੀਆਂ ਨੂੰ ਕੋਈ ਚਿੰਤਾਵਾਂ ਕਰਨੀ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੱਕ ਪੰਜਾਬ ਦੇ ਲੋਕ ਬਹੁਤ ਹੀ ਇਮਾਨਦਾਰ ਬਹੁਤ ਹੀ ਦਿਲਦਾਰ ਲੋਕ ਨੇ ਜੋ ਕਿ ਬਾਹਰਲੇ ਰਾਜਾਂ ਦੇ ਲੋਕ ਜੋ ਇੱਥੇ ਆਉਂਦੇ ਆ ਜੋ ਸੈਲਾਨੀ ਆਉਂਦੇ ਆ ਉਹਨਾ ਨੂੰ ਬੜੇ ਉਹ ਪਿਆਰ ਅਤੇ ਸਤਿਕਾਰ ਦਿੰਦੇ ਨੇ ਲੋਕ ਤਾਂ ਚਿੰਤਾ ਕਰਨ ਦੀ ਸੈਲਾਨੀਆਂ ਨੂੰ ਕੋਈ ਜ਼ਰੂਰਤ ਨਹੀਂ ਹੈ ਲੇਕਿਨ ਹਾਂ ਜੋ ਟੂਰਿਸਟ ਜੋ ਸੈਲਾਨੀ ਲੋਕ ਹੁੰਦੇ ਆ ਉਹਨਾਂ ਨੂੰ ਜੋ ਟੂਰਿਸਟ ਦੇ ਆਲ ਇੰਡੀਆ ਜਾਂ ਆਲ ਵਰਲਡ ਦੇ ਵਿੱਚ ਜੋ ਵੀ ਰੂਲਸ ਵਗੈਰਾ ਹੁੰਦੇ ਹੈ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਸੈਲਾਨਿਆ ਨੂੰ ਲੇਕਿਨ ਪੰਜਾਬ ਦੇ ਵਿੱਚ ਆਉਣ ਲਈ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਲੋਕ ਬੜੇ ਖੁਸ਼ ਹੈ ਖੁਸ਼ ਹੋਣ ਦੇ ਨਾਲ ਨਾਲ ਬੜੇ ਇਮਾਨਦਾਰ ਅਤੇ ਬੜੇ ਦਿਲਦਾਰ ਲੋਕ ਹੈ ਸੋ ਸੈਲਾਨੀਆਂ ਨੂੰ ਚਿੰਤਾਵਾਂ ਕਰਨ ਦੀ ਕੋਈ ਜ਼ਰੂਰਤ ਨਹੀ ਹੈ ਲੇਕਿਨ ਹਾਂ ਜੋ ਸੋਸ਼ਲ ਮੀਡੀਆ 'ਤੇ ਦਿਖਾਇਆ ਜਾਂਦਾ ਉਹ ਪਤਾ ਨਹੀਂ ਕੌਣ ਲੋਕ ਨੇ ਜੋ ਪੰਜਾਬ ਬਾਰੇ ਇੰਨੀਆਂ ਗਲਤ ਅਫਵਾਹਾਂ ਪੇਸ਼ ਕਰਦੇ ਆ ਕਿ ਪੰਜਾਬ ਇੱਕ ਪੰਜਾਬ ਇੱਕ ਸੁਰੱਖਿਅਤ ਸੁਰੱਖਿਅਤ ਰਾਜ ਨਹੀਂ ਹੈ ਬਟ ਐਸਾ ਕੁਛ ਨਹੀਂ ਹੈ ਅਸੀਂ ਖੁਦ ਪੰਜਾਬ ਦੇ ਵਾਸੀ ਹਾਂ ਅਸੀਂ ਜਿੱਥੋਂ ਤੱਕ ਪੰਜਾਬ ਨੂੰ ਓਬਜਰਵ ਕੀਤਾ ਕਿ ਉਹ ਬੜਾ ਵਧੀਆ ਰਾਜ ਹੈ ਰਹਿਣ ਯੋਗ ਰਾਜ ਹੈ ਔਰ ਇੱਥੇ ਜੋ ਸੈਲਾਨੀ ਆਉਂਦੇ ਹੈ ਬੇਸ਼ੱਕ ਉਹ ਸਾਡੇ ਅਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰਨ ਉੱਥੇ ਟੂਰਿਸਟ ਆਉਣ ਜਾਂ ਚਾਹੇ ਉਹ ਗੋਲਡਨ ਟੈਂਪਲ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਗੋਲਡਨ ਟੈਂਪਲ ਤਾਂ ਵੈਸੇ ਵੀ ਇਸ ਤਰ੍ਹਾਂ ਦਾ ਟੂਰਿਸਟ ਪਲੇਸ ਬਣ ਗਿਆ ਲੇਕਿਨ ਉਹ ਸਿੱਖਾਂ ਲਈ ਤਾਂ ਇੱਕ ਬੜਾ ਧਾਰਮਿਕ ਸਥਾਨ ਹੈ ਪੰਜਾਬੀਆਂ ਲਈ ਉਹ ਇੱਕ ਧਾਰਮਿਕ ਸਥਾਨ ਹੈ ਲੇਕਿਨ ਜੋ ਉਹਨੂੰ ਦੁਨੀਆ ਦੇਖਦੀ ਉਹ ਇੱਕ ਟੂਰਿਸਟ ਪਲੇਸ ਦੇ ਤੌਰ 'ਤੇ ਦੇਖਦੀ ਹੈ ਹੁਣ ਤੱਕ ਜੋ ਗਿਨੀਜ਼ ਰਿਕਾਰਡ ਦੇ ਵਿੱਚ ਰਿਕਾਰਡ ਦਰਜ ਹੈ ਕਿ ਉਹ ਮੋਸਟ ਵਿਜਿਟਿਡ ਪਲੇਸ ਹੈ ਹਰਿਮੰਦਰ ਸਾਹਿਬ ਤਾਂ ਉੱਥੇ ਬਹੁਤ ਸੈਲਾਨੀ ਆਉਂਦੇ ਆ ਨਾ ਕਿ ਇਕੱਲੇ ਇੰਡੀਆ ਦੇ ਰਾਜਾਂ ਤੋਂ ਆਉਂਦੇ ਉਹ ਵੱਖ ਵੱਖ ਦੇਸ਼ਾਂ ਤੋਂ ਵੀ ਜਿਵੇਂ ਕਿ ਕਨੇਡਾ ਅਮੈਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟਰੇਲੀਆ ਜਾਂ ਹੋਰ ਵੀ ਕੰਟਰੀਆਂ ਤੋਂ ਲੋਕ ਹੋਰ ਵੀ ਦੇਸ਼ਾਂ ਤੋਂ ਲੋਕ ਇੱਥੇ ਐਜ ਏ ਟੂਰਿਸਟ ਆਉਂਦੇ ਆ ਤਾਂ ਉਸ ਹਿਸਾਬ ਨਾਲ ਜੇ ਅਸੀਂ ਇਸ ਗੱਲ ਕਰੀਏ ਤਾਂ ਇੱਥੇ ਸੈਲਾਨੀਆਂ ਨੂੰ ਕੋਈ ਚਿੰਤਾਵਾਂ ਕਰਨ ਦੀ ਜ਼ਰੂਰਤ ਨਹੀਂ ਹੈ ਹੈ ਨਾ ਲੇਕਿਨ ਜੋ ਗਲਤ ਅਫਵਾਹਾਂ ਜੋ ਸ਼ੋਸ਼ਲ ਮੀਡੀਆ 'ਤੇ ਹਨ ਉਹ ਪਤਾ ਨਹੀਂ ਕੌਣ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਂਦਾ ਕਿ ਪੰਜਾਬ ਸੁਰੱਖਿਅਤ ਰਾਜ ਨਹੀਂ ਹੈ ਲੇਕਿਨ ਪੰਜਾਬ ਵਾਸੀਆਂ ਲਈ ਪੰਜਾਬ ਇੱਕ ਬੜਾ ਸੁਰੱਖਿਅਤ ਦੇਸ਼ ਹੈ ਸੁਰੱਖਿਅਤ ਰਾਜ ਹੈ ਸੋ ਸੈਲਾਨੀਆਂ ਨੂੰ ਕੋਈ ਚਿੰਤਾਵਾਂ ਕਰਨ ਦੀ ਜ਼ਰੂਰਤ ਨਹੀਂ ਹੈ ਹਾਂ ਲੇਕਿਨ ਜੋ ਉਹਨਾਂ ਦੇ ਡਾਕੂਮੈਂਟ ਨੇ ਲਾਈਕ ਡੋਮੀਸਾਈਲ ਹੈ ਜਾਂ ਹੋਰ ਵੀ ਜੋ ਟੂਰਿਸਟ ਟਰੈਵਲ ਦੇ ਨਾਲ ਜੋ ਰੂਲਸ ਰੈਗੂਲੇਸ਼ਨ ਦੇ ਹਿਸਾਬ ਨਾਲ ਜੋ ਉਹਨਾਂ ਦੇ ਡਾਕੂਮੈਂਟ ਉਹ ਪੂਰੇ ਹੋਣੇ ਚਾਹੀਦੇ ਇਹ ਧੰਨਵਾਦ